ਬੱਚਿਆਂ ਲਈ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਕੋਈ ਨਿਸ਼ਚਿਤ ਉਮਰ ਨਹੀਂ ਹੁੰਦੀ ਇਹਨਾਂ ਨੂੰ ਇਹ ਸਿਖਲਾਈ ਸਕੂਲ ਦੇ ਸ਼ੁਰੂਆਤੀ ਸਮੇਂ ਤੋਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹਨਾਂ ਨੂੰ ਸਿਖਲਾਈ ਟੀਚਰਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਇਹ ਬੱਚੇ ਆਪਣੀ ਕਲਾ ਦਾ ਨਿਖਾਰ ਹੌਲੀ ਹੌਲੀ ਵੱਡੀਆਂ ਜਮਾਤਾਂ ਤੱਕ ਹੋਰ ਕਰ ਦਿੰਦੇ ਹਨ